ਹੈਲੋ ਸਰ ਤੁਸੀਂ ਵੀਰ ਕੁਮਾਰ ਸਰ ਤੁਸੀਂ ਕੋਚਿੰਗ ਤੋਂ ਬੋਲ ਰਹੇ ਹੋ ਸਪੋਰਟਸ ਕੋਚਿੰਗ ਤੋਂ ਸਰ ਮੈਂ ਤੁਹਾਡੇ ਕੋਲ ਐਮ ਐਡਮਿਸ਼ਨ ਕਰਵਾਉਣੀ ਸੀ ਜੀ ਸਰ ਮੈਂ ਵੀਰਪਾਲ ਖਿਲਣ ਤੋਂ ਸਰ ਮੈਂ ਮਤਲਬ ਕੋਚਿੰਗ ਫੀਸ ਕਿੱਥੇ ਕਿੰਨੀ ਕੁ ਹੈਗੀ ਨਹੀਂ ਓਕੇ ਸਰ ਸਰ ਮਤਲਬ ਕਿ ਆਪਣੇ ਇੱਥੇ ਗੇਮਸ ਕਿਹੜੀਆਂ ਕਿਹੜੀਆਂ ਨੇ ਸਰ ਮਤਲਬ ਕਿ ਸਾਰੇ ਕੋਚਿੰਗ ਦੇ ਟੀਚਰ ਆਪ ਹੀ ਹੋ ਕਿ ਹੋਰ ਵੀ ਟੀਚਰ ਰੱਖੇ ਹੋਏ ਨੇ ਅਲੱਗ ਓਕੇ ਸਰ ਸਰ ਮਤਲਬ ਕਿ ਮਤਲਬ ਸਾਰਿਆਂ ਦੀ ਫੀਸ ਇੱਕੋ ਹੀ ਹੈ ਕੋਈ ਅਲੱਗ ਅਲੱਗ ਹੈ ਸਰ ਮਤਲਬ ਕਿ ਆਪਣੇ ਉਰੇ ਨੇੜੇ ਕਿਹੜਾ ਸੈਂਟਰ ਬਣਿਆ ਹੋਇਆ ਤੁਹਾਡਾ ਕਿੱਥੇ ਕੁ ਪੈ ਜਾਂਦਾ ਸਰ ਇਹ ਅੱਛਿਆ ਸਰ ਸਰ ਉਹ ਮਤਲਬ ਕਿ ਉਰੇ ਕਿਵੇਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਮਤਲਬ ਸਰ ਸਰ ਮਤਲਬ ਕਿ ਆਪਣੇ ਓਡੀਨਲ ਜਿਹੜਾ ਜਵਾਕ ਹੀ ਪਹਿਲਾਂ ਖੇਡਿਆਂ ਹੁੰਦਾ ਕਿ ਉਹਨੂੰ ਈ ਸ਼ੁਰੂ ਤੋਂ ਹੀ ਖਿਡਾਇਆ ਜਾਂਦਾ ਗਾ ਅਤੇ ਸਰ ਮਤਲਬ ਕਿ ਜਿਹੜਾ ਹੁਣ ਜਵਾਕ ਹੁਣ ਮਤਲਬ ਦੂਰ ਦੂਰ ਖੇਡਿਆ ਹੋਵੇ ਮਤਲਬ ਉਹਨੇ ਮਤਲਬ ਥੋੜ੍ਹੇ ਘਣੇ ਮੈਂ ਅੰਤਰ ਰਾਸ਼ਟਰੀ ਖੇਡਿਆ ਹੁਣ ਸਿੱਧਾ ਤੁਸੀਂ ਅੰਤਰ ਰਾਸ਼ਟਰੀ ਲੈ ਕੇ ਆਓਗੇ ਖੇਡਾਂ ਦੇ ਵਿੱਚ ਕਿ ਜੀ ਪਹਿਲਾਂ ਕੈਂਪ ਸ਼ੁਰੂ ਤੋਂ ੜ੍ਹੇ ਲਗਵਾਏ ਜਾਣਗੇ ਓਕੇ ਸਰ ਥੈਂਕ ਯੂ ਸਰ ਤੁਸੀਂ ਮੈਨੂੰ ਆਪਣਾ ਕੀਮਤੀ ਸਮਾਂ ਦਿੱਤਾ